ਭਾਰਤ ਦੇ ਉੱਤਰ ਪੱਛਮ ਇਲਾਕੇ ਵਿੱਚ ਵਸਦੇ ਲੋਕ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਭਾਰਤ ਦੇ ਇਲਾਕਿਆਂ ਤੋਂ ਇਲਾਵਾ ਅਮ ਅਮੈਰੀਕਾ ਕਨੇਡਾ ਅਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਵਸਣ ਵਾਲੇ ਜੋ ਜ਼ਿਆਦਾਤਰ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਲੋਕ ਨੇ ਅਤੇ ਇਹਦੀ ਜਿਹੜੀ ਵ ਮੂਲ ਲਿਪੀ ਹੈ ਉਹ ਗੁਰਮੁਖੀ ਲਿਪੀ ਵਜੋਂ ਹੀ ਜਾਣੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਇਹਨੂੰ ਦੁਨੀਆ ਦੀਆਂ ਹੋਰ ਲਿਪੀਆਂ ਦੇ ਵਿੱਚ ਵੀ ਲਿਖਿਆ ਜਾ ਸਕਦਾ ਹੈ ਅਤੇ ਇਹਦੇ ਜਿਹੜੇ ਬੋਲਣ ਦੇ ਇਲਾਕੇ ਨੇ ਉਹ ਵੱਖਰੇ ਵੱਖਰੇ ਇਲਾਕਿਆਂ ਵਿੱਚ ਇਹਦੀ ਸਕ੍ਰਿਪਟ ਥੋੜ੍ਹੀ ਜਿਹੀ ਬਦਲ ਜਾਂਦੀ ਨੇ ਗੁਰਮੁਖੀ ਲਿਪੀ ਦੇ ਵਿੱਚ ਪੂਰੇ ਪੈਂਤੀ ਅੱਖਰ ਨੇ ਅਤੇ ਬਾਕੀ ਦੇ ਇਹਦੇ ਜਿਹੜੇ ਸੱਤ ਅੱਖਰ ਨੇ ਉਹ ਫਾਰਸੀ ਭਾਸ਼ਾ ਦੇ ਵਿੱਚੋਂ ਲਏ ਗਏ ਨੇ ਇਹਦੀਆਂ ਵੱਖਰੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਨੇ ਜਿਵੇਂ ਵਿਆਕਰਨ ਹੈ ਇਹਦਾ ਆਪਣਾ ਵਿਆਕਰਨ ਹੈ ਭਾਸ਼ਾ ਦਾ ਲਿਪੀ ਦਾ ਅਤੇ ਇਹਦਾ ਉਚਾਰਨ ਵੀ ਵੱਖਰਾ ਵੱਖਰਾ ਹੈ ਜਿਵੇਂ ਸ ਨੂੰ ਸ ਬੋਲਿਆ ਜਾਂਦਾ ਹੈ ਅਤੇ ਸ ਪੈਰ ਬਿੰਦੀ ਨੂੰ ਸ਼ ਬੋਲਿਆ ਜਾਂਦਾ ਹੈ ਇਹਦੇ ਜੋ ਉਚਾਰਨ ਔਖੇ ਨੇ ਜਿਹੜੇ ਸ਼ਬਦਾਂ ਦੇ ਉਹਦੇ ਵਿੱਚ ਆ ਜਾਂਦੇ ਨੇ ਙ ਞ ਅਤੇ ਜਿਹੜੇ ਜਿਹੜੇ ਸ਼ਬਦਾਂ ਦੇ ਉਚਾਰਨ ਵਿੱਚ ਫਰਕ ਕਰਨਾ ਔਖਾ ਹੋ ਜਾਂਦਾ ਹੈ ਥੋੜ੍ਹਾ ਜਿਹਾ ਉਹ ਹੈਗਾ ਨ ਣ ਇੱਦਾਂ ਅਤੇ ਇਹਦੇ ਵਿੱਚ ੳ ਅ ਅਤੇ ੲ ਤਿੰਨ ਸਵਰ ਹੁੰਦੇ ਨੇ ਅਤੇ ਬਾਕੀ ਸਾਰੇ ਦੇ ਸਾਰੇ ਵਿਅੰਜਨ ਹੁੰਦੇ ਨੇ ਇਸ ਤਰ੍ਹਾਂ ਇਹਦੀ ਜਿਹੜੀ ਲਿਪੀ ਦੇ ਪੈਂਤੀ ਅੱਖਰ ਨੇ ਉਹਨੂੰ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਜਿਵੇਂ ਪਹਿਲੇ ਪੰਜ ਅੱਖਰ ੳ ਅ ੲ ਸ ਹ ਹੁੰਦੇ ਨੇ ਉਸ ਤੋਂ ਬਾਅਦ ਕ ਨਾਲ ਸ਼ੁਰੂ ਹੋਣ ਵਾਲੇ ਨੂੰ ਕਵਰਗ ਕਹਿੰਦੇ ਨੇ ਟ ਨਾਲ ਸ਼ੁਰੂ ਹੋਣ ਵਾਲੇ ਨੂੰ ਟਵਰਗ ਤ ਨਾਲ ਸ਼ੁਰੂ ਹੋਣ ਵਾਲੇ ਨੂੰ ਤਵਰਗ ਪ ਨਾਲ ਸ਼ੁਰੂ ਹੋਣ ਵਾਲੇ ਨੂੰ ਪਵ ਪਵਰਗ ਬੋਲਿਆ ਜਾਂਦਾ ਹੈ ਅਤੇ ਇਹਦੀ ਆਪਣੀ ਹੀ ਲਿਪੀ ਦੀ ਇੱਕ ਵਿਆਕਰਨ ਹੈ ਜਿਹੜੀ ਆਪਣੇ ਆਪ ਦੇ ਵਿੱਚ ਹੀ ਸੰਪੂਰਨ ਤੌਰ 'ਤੇੇ ਜਾਣੀ ਜਾਂਦੀ ਹੈ